ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਬੋਲੋ ਬੇਟਾ ਆਪਣੀ ਬਰਨਾਲਾ 'ਚ ਬੇਟਾ ਮੇਨ ਚੌਂਕ 'ਚ ਤੁਸੀਂ ਕਿਸ ਰੇਂਜ ਦੇ ਲੈਣੇ ਬੇਟਾ ਕਿਸ ਕੰਪਨੀ ਨੂੰ ਦੇ ਲੈਣੇ ਆ ਆਪਣੇ ਕੋਲ ਸਾਰੀਆਂ ਕੰਪਨੀ ਦੇ ਆ ਪਿਊਮਾ ਹੋ ਗਿਆ ਐਡੀਡਸ ਹੋ ਗਿਆ ਨਾਇਕੀ ਹੋ ਗਿਆ ਜੋਰਡਨ ਵੀ ਲੈ ਕੇ ਆਏ ਹਾਂ ਆਪਾਂ ਹੁਣ ਅੱਛਾ ਤੁਹਾਨੂੰ ਬੇਟਾ ਇੱਕ ਖੁਸ਼ਖਬਰੀ ਮੈਂ ਦੇ ਰਿਹਾ ਹੈਗਾ ਜੇ ਤੁਸੀਂ ਇੱਕ ਦੋ ਦਿਨਾਂ 'ਚ ਸ਼ੋਪਿੰਗ ਕਰ ਲਉਂਗੇ ਆਪਣੇ ਕੋਲੋਂ ਤੁਹਾਨੂੰ ਇੱਕ ਲੇਡੀਜ ਸਲਿਪਰ ਨਾ ਫਰੀ ਦੇ ਦਾਂਗੇ ਤਿੰਨ ਜੋੜਿਆਂ ਦੇ ਨਾਲ ਸੇਲ ਲਾ ਰੱਖੀ ਆਪਾਂ ਨੇ ਅਤੇ ਵਰਾਇਟੀਆਂ ਆਪਣੇ ਕੋਲ ਹੋਰ ਵੀ ਆ ਹਾਂ ਤੁਸੀਂ ਦੇਖੋ ਆ ਕੇ ਕਰੋ ਪਸੰਦ ਬਾਕੀ ਦੂਜੀ ਗੱਲ ਤੁਹਾਨੂੰ ਹੋਰ ਦੱਸਾਂ ਆਪਾਂ ਔਨਲਾਈਨ ਵੀ ਕਰ ਦਿੰਦੇ ਹਾਂ ਜੇ ਤੁਸੀਂ ਔਨਲਾਈਨ ਕਹੋ ਮੈਨੂੰ ਤੁਸੀਂ ਆਪ ਕੰਪਨੀ ਦੱਸ ਦਿਓ ਆਪਦਾ ਪੈਰ ਦਾ ਨਾਪ ਦੱਸ ਦਿਓ ਤੋ ਐਡਰੈਸ ਦੇ ਦਿਓ ਤੁਹਾਨੂੰ ਔਨਲਾਈਨ ਵੀ ਡਿਲੀਵਰੀ ਕਰਾ ਦਾਂਗੇ ਆਪਾਂ ਉਹਦਾ ਕੋਈ ਚਾਰਜ ਨਹੀਂ ਜੀ ਬੈਠੇ ਹਾਂ ਬੇਟਾ ਇਸ ਗੱਲ ਦੀ ਆਪਾਂ ਸੌ ਹੰਡਰਡ ਪਰਸੈਂਟ ਗਰੰਟੀ ਦਿੰਦੇ ਹਾਂ ਜਦੋਂ ਮਰਜ਼ੀ ਤੁਸੀਂ ਇੱਕ ਦੋ ਦਿਨਾਂ ਸਿਰਫ ਉਹ ਵਾਪਸ ਭੇਜ ਦਿਓ ਤੁਹਾਨੂੰ ਚੇਂਜ ਕਰਕੇ ਨਵਾਂ ਦਿੱਤਾ ਜਾਵੇਗਾ ਤੁਹਾਨੂੰ ਉਹਦੇ ਨਾਲ ਓਰਿਜਨਲ ਬਿਲ ਜੀਐਸਟੀ ਵਾਲਾ ਕੱਟ ਕੇ ਦਿੱਤਾ ਜਾਵੇਗਾ ਬੇਟਾ ਜੀ ਪੱਕਾ ਬਿੱਲ ਹਾਂਜੀ ਹਾਂਜੀ ਉਹਨਾਂ ਨਾਲ ਤਾਂ ਜੀ ਆਪਣੇ ਘਰ ਵਾਲੇ ਰਿਲੇਸ਼ਨ ਕੁਛ ਵੀ ਫੰਕਸ਼ਨ ਹੋਵੇ ਕੁਝ ਵੀ ਉਹਨਾਂ ਤੋਂ ਉਹਨਾਂ ਤੋਂ ਤੁਸੀਂ ਸਾਡੇ ਨਾਂ ਬਾਰੇ ਚੰਗੀ ਤਰ੍ਹਾਂ ਜਾਣ ਸਕਦੇ ਹੋ ਸਾਡਾ ਵਿਵਹਾਰ ਜਿਵੇਂ ਆਪਾਂ ਘਰ ਦਾ ਹੁੰਦਾ ਨਾ ਉਹਨਾਂ ਨਾਲ ਇਸ ਤਰ੍ਹਾਂ ਚਲਦਾ ਠੀਕ ਹੈ